ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ

ਹਾਂਜੀ ਕਿਹੜੀ ਕਲਾਸ 'ਚ ਤੁਹਾਡਾ ਬੱਚਾ ਹਾਂਜੀ ਹਾਂਜੀ ਬੋਲੋ ਸਿਕਸ ਕਲਾਸ ਸੈਕਸ਼ਨ ਸੈਕਸ਼ਨ ਕਿਹੜਾ ਜੀ ਠੀਕ ਆ ਜੀ ਹਾਂਜੀ ਬੋਲੋ ਪਰ ਪਰ ਮੈਮ ਤੁਹਾਨੂੰ ਪਤਾ ਸਕੂਲ 'ਚ ਤਾਂ ਪੇਪਰ ਚੱਲ ਰਹੇ ਨੇ ਨਾ ਅਤੇ ਛੁੱਟੀ ਤੁਹਾਨੂੰ ਪਤਾ ਪੋਸੀਬਲ ਨਹੀਂ ਹੈ ਹਾਂਜੀ ਹਾਂਜੀ ਹਾਂਜੀ

ਹਾਂਜੀ ਪਰ ਮੈਮ ਤੁਹਾਨੂੰ ਪਤਾ ਪੇਪਰ ਦੇ ਡੇ ਵਿੱਚ ਛੁੱਟੀ ਆ ਤੁਸੀਂ ਪੇਪਰ ਦਵਾ ਕੇ ਲੈ ਜਾਇਓ ਇਹਨੂੰ ਤੁਸੀਂ ਫਸਟ ਟਾਈਮ 'ਤੇ ਇਹਦਾ ਪੇਪਰ ਲੈ ਲਾਂਗੇ ਤੁਸੀਂ ਫਿਰ ਲੈ ਜਾਇਓ ਇਹਨੂੰ ਹਾਂ ਜੀ ਤੁਸੀਂ ਫਸਟ ਜਦੋਂ ਸਟਾਰਟ ਹੁੰਦਾ ਉਸ ਟਾਈਮ 'ਤੇ ਜਾਂ ਫਿਰ ਛੁ ਪੇਪਰ ਦਵਾ ਦਿਓ ਇਹਦਾ ਅਤੇ ਪੇਪਰ ਦਵਾ ਕੇ ਇਹਨੂੰ ਲੈ ਜਾਇਓ ਨਹੀਂ ਤੁਸੀਂ ਤੁਸੀਂ ਇੱਕ ਦਿਨ ਪਹਿਲਾਂ ਜਾਣਾ ਜਾਂ ਉਸੇ ਦਿਨ ਜਾਣਾ ਤੁਸੀਂ ਕਿਸ ਦਿਨ ਲੀਵ ਚਾਹੀਦੀ ਆ ਤੁਹਾਨੂੰ ਅਤੇ ਪੇਪਰ ਵਾਲੇ ਦਿਨ ਤੁਸੀਂ ਆ ਜਾਣਾ ਜਾਂ ਨਹੀਂ ਆਣਾ ਹਾਂਜੀ ਫਿਰ ਮੈਮ ਤੁਸੀਂ ਇੱਕ ਇੱਦਾਂ ਕਰਿਓ ਫਿਰ ਇੱਕ ਐਪਲੀਕੇਸ਼ਨ ਲਿਖ ਕੇ ਦੇ ਦਿਓ ਸਾਨੂੰ ਫਿਰ ਅਤੇ ਫਿਰ ਅਸੀਂ ਤੁਹਾਡੇ ਬੱਚੇ ਦਾ ਪੇਪਰ ਲੈ ਲਾਂਗੇ ਫਿਰ ਮੈਮ ਇਹੀ ਹੋ ਸਕਦਾ ਫਿਰ ਹਾਂ ਪੇਪਰ ਦੇ ਹਾਂਜੀ ਪੇਪਰ ਲੈਣਾ ਹੀ ਪੈਣਾ ਜੀ ਸਾਨੂੰ ਤੁਸੀਂ ਨਹੀਂ ਨਹੀਂ ਨਹੀਂ ਨਹੀਂ ਮੈਮ ਪੇਪਰ ਲੈਣਾ ਹੀ ਪਏਗਾ ਕਿਉਂਕਿ ਫਾਈਨਲ ਪੇਪਰ ਨੇ ਨਾ ਫਾਈਨਲ ਪੇਪਰ ਨਹੀਂ ਅਸੀਂ ਛੱਡ ਦੇ ਨਹੀਂ ਨਹੀਂ ਨਹੀਂ ਮੈਮ ਤੁਸੀਂ ਲੀਵ ਦੇ ਦੇਣਾ ਬਸ ਇੰਨਾ ਹੋ ਜਾਏਗਾ ਵੀ ਇੱਕ ਦਿਨ ਬਾਅਦ 'ਚੋ ਪੇਪਰ ਲੈ ਲਾਂਗੇ ਅਸੀਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਇੱਕ ਨਹੀਂ ਮੈਮ ਪੇਪਰ ਉਸ ਦਿਨ ਖਤਮ ਹੋ ਜਾਣੇ ਨਾ ਇਹਨਾਂ ਦਾ ਲਾਸਟ ਪੇਪਰ ਹੀ ਆ ਸਿਕਸਥ ਕਲਾਸ ਦਾ ਲਾਸਟ ਪੇਪਰ ਹੀ ਆ ਹਾਂਜੀ ਮੈਮ ਹਾਂਜੀ ਔਰ ਜਰੂਰੀ ਹੈ ਮੈਮ ਠੀਕ ਆ ਓਕੇ ਓਕੇ ਵੈਲਕਮ ਮੈਮ ਓਕੇ ਮੈਮ